ਮੈਂ ਆਨਲਾਈਨ ਇੱਕ ਪ੍ਰੋਡਕਟ ਮੰਗਾਇਆ ਜੋ ਕਿ ਏਅਰਿੰਗ ਸਨ ਔਰ ਏਅਰਿੰਗਸ ਪਿੱਕਚਰ ਦੇ ਵਿੱਚ ਵੇਖਣ ਦੇ ਵਿੱਚ ਬਹੁਤ ਹੀ ਜ਼ਿਆਦਾ ਖੂਬਸੂਰਤ ਅਤੇ ਵਧੀਆ ਲੱਗਦੇ ਸਨ ਜਦੋਂ ਉਹਨਾਂ ਦਾ ਮੈਂ ਆਰਡਰ ਕੀਤਾ ਅਤੇ ਉਹ ਜਦੋਂ ਮੇਰੇ ਕੋਲ ਪਹੁੰਚੇ ਮੈਂ ਇੱਕ ਸਪੈਸ਼ਲ ਫੰਕਸ਼ਨ ਦੇ ਉੱਤੇ ਆਪਣੀ ਡ੍ਰੈਸ ਦੇ ਨਾਲ ਮੈਚ ਕਰਕੇ ਉਹਨਾਂ ਨੂੰ ਵੇਅਰ ਕੀਤਾ ਪਰ ਜਦੋਂ ਮੈਂ ਉਹਨਾਂ ਨੂੰ ਵੇਅਰ ਕੀਤਾ ਤਾਂ ਉਹਨਾਂ ਦੇ ਜਿਹੜੇ ਸਟੋਨ ਆ ਬਹੁਤ ਹੀ ਚੀਪ ਕੁਆਲਿਟੀ ਦੇ ਲੱਗੇ ਹੋਏ ਸਨ ਉਹ ਨਿਕਲ ਕੇ ਮੇਰੀ ਡਰੈਸ ਦੇ ਉੱਤੇ ਆ ਗਏ ਸਨ ਜੋ ਕਿ ਮੈਨੂੰ ਚੁੱਬ ਰਹੇ ਸਨ ਤਾਂ ਮੈਨੂੰ ਲੱਗਿਆ ਕਿ ਇਹ ਸ਼ਾਇਦ ਕੋਈ ਕਿਸੇ ਵਜ੍ਹਾ ਦੇ ਨਾਲ ਟੁੱਟ ਰਹੇ ਹੋਣ ਪਰ ਜਦੋਂ ਮੈਂ ਉਹਨਾਂ ਨੂੰ ਉਤਾਰ ਕੇ ਦੇਖਿਆ ਤਾਂ ਉਹਨਾਂ ਨੇ ਮੇਰੇ ਜਿਹੜੇ ਏਰਿੰਗਸ ਦੇ ਹੋਲਸ ਹੁੰਦੇ ਆ ਉਹਨਾਂ ਦੇ ਵਿੱਚ ਇਨਫੈਕਸ਼ਨ ਵੀ ਕਰ ਦਿੱਤੀ ਸੀ ਜਿਹਦੇ ਨਾਲ ਮੇਰੇ ਕੰਨ ਵੀ ਖਰਾਬ ਹੋ ਗਏ ਸਨ ਅਤੇ ਉਹਨਾਂ ਦਾ ਜਿਹੜਾ ਮਟੀਰੀਅਲ ਸਾਰਾ ਏਰਿੰਗ ਤੋਂ ਤਿਆਰ ਕੀਤਾ ਹੋਇਆ ਸੀ ਉਹ ਬਹੁਤ ਹੀ ਚੀਪ ਕੁਆਲਿਟੀ ਦਾ ਸੀ ਉਹ ਮਾੜੇ ਜੇ ਦੇ ਹੱਥ ਲਾਇਆਂ ਹੀ ਟੁੱਟ ਰਹੇ ਸਨ ਜਿਹੜੇ ਸਟੋਨ ਸੀ ਉਹਦੇ ਸਾਰੇ ਹੀ ਨਿਕਲ ਗਏ ਸਨ ਅਤੇ ਜਿਹੜੇ ਉਹਨਾਂ ਦੀਆਂ ਜਿਹੜੀਆਂ ਕੌਲੀਆਂ ਸਨ ਉਹ ਵੀ ਟੁੱਟ ਗਈਆਂ ਸਨ ਤਾਂ ਜਦ ਉਹਨਾਂ ਨੂੰ ਵੇਅਰ ਕਰਨਾ ਮੈਨੂੰ ਬਹੁਤ ਹੀ ਔਖਾ ਲੱਗਿਆ ਉਹਨਾਂ ਦੀ ਜਿਹੜੀ ਕੁਆਲਿਟੀ ਸੀ ਉਹ ਬਹੁਤ ਜ਼ਿਆਦਾ ਹੀ ਘਟੀਆ ਘਟੀਆ ਸੀਗੀ ਅਤੇ ਜਿਸ ਦੇ ਨਾਲ ਮੈਨੂੰ ਉਹ ਏਅਰਿੰਗ ਔਨਲਾਈਨ ਮੰਗਾਏ ਵਧੀਆ ਨਹੀਂ ਲੱਗੇ ਇਸ ਤੋਂ ਵਧੀਆ ਤਾਂ ਔਫਲਾਈਨ ਜਿਹੜੀ ਮੈਂ ਮੰਗਵਾਏ ਸੀ ਉਹ ਬਹੁਤ ਜ਼ਿਆਦਾ ਵਧੀਆ ਸਨ ਜਿਹਦੇ ਵਿੱਚ ਉਹ ਮੇਰੀ ਡ੍ਰੈਸ ਦੇ ਨਾਲ ਜਦੋਂ ਮੈਂ ਵੇਅਰ ਕੀਤੇ ਤਾਂ ਉਹ ਬਹੁਤ ਹੀ ਖੂਬਸੂਰਤ ਲੱਗ ਰਹੇ ਸਨ ਕਿਉਂਕਿ ਆਨਲਾਈਨ ਮੰਗਾਈ ਚੀਜ਼ ਅਸੀਂ ਉਸਨੂੰ ਛੂਹ ਕੇ ਨਹੀਂ ਦੇਖ ਸਕਦੇ ਕਿ ਉਹ ਕਿਸ ਤਰ੍ਹਾਂ ਦੀ ਹੈ ਬਟ ਔਫਲਾਈਨ ਅਸੀਂ ਦੇਖ ਸਕਦੇ ਹਾਂ ਕੀ ਉਸ ਦੀ ਜਿਹੜਾ ਮਟੀਰੀਅਲ ਉਹ ਵਧੀਆ ਯੂਜ਼ ਕੀਤਾ ਗਿਆ ਹੈ ਕਿ ਨਹੀਂ ਕੀਤਾ ਗਿਆ ਇਸ ਕਰਕੇ ਸਾਨੂੰ ਔਫਲਾਈਨ ਚੀਜ਼ਾਂ ਵੱਧ ਤੋਂ ਵੱਧ ਮੰਗਾਉਣੀਆਂ ਚਾਹੀਦੀਆਂ ਹਨ ਨਾ ਕਿ ਔਨਲਾਈਨ ਔਨਲਾਈਨ ਚੀਜ਼ਾਂ ਦੇ ਵਿੱਚ ਕਈ ਵਾਰ ਮਟੀਰੀਅਲ ਘਟੀਆ ਯੂਜ ਹੁੰਦਾ ਹੈ ਤਾਂ ਉਹ ਸਾਨੂੰ ਵੇਖ ਕੇ ਪਤਾ ਨਹੀਂ ਲੱਗਦਾ ਜਿਸ ਨਾਲ ਅਸੀਂ ਵਈ ਆਪਣੀ ਜਿਹੜੀ ਇਹ ਚੀਜ਼ ਆ ਆਪਣੇ ਪੈਸੇ ਨੂੰ ਬਰਬਾਦ ਕਰ ਲੈਂਦੇ ਹਾਂ